ਸਤਿ ਸ਼੍ਰੀ ਕਾਲ ਜੀ ਵੈਸੇ ਤਾਂ ਮੈਨੂੰ ਬਹੁਤ ਸਾਰੇ ਕਵੀ ਅਤੇ ਲੇਖਕ ਵਧੀਆ ਲੱਗਦੇ ਹਨ ਅਤੇ ਮੈਂ ਉਹਨਾਂ ਦੀਆਂ ਕਿਤਾਬਾਂ ਅਤੇ ਕਹਾਣੀਆਂ ਅਤੇ ਕਵਿਤਾਵਾਂ ਪੜ੍ਹਦੀ ਹੀ ਰਹਿੰਦੀ ਹਾਂ ਪਰ ਜੋ ਮੈਨੂੰ ਸਭ ਤੋਂ ਵਧੀਆ ਜੋ ਕਵੀ ਲੱਗਦੇ ਹਨ ਉਹ ਭਾਈ ਵੀਰ ਸਿੰਘ ਜੀ ਹਨ ਉਹਨਾਂ ਦਾ ਪਤਾ ਜਦੋਂ ਮੈਂ ਸਕੂਲ ਵਿੱਚ ਹੁੰਦੀ ਹਾਂ ਉਦੋਂ ਪਤਾ ਲੱਗਿਆ ਕਿਉਂਕਿ ਸਾਡੀ ਦਸਵੀਂ ਦੀ ਜਮਾਤ ਵਿੱਚ ਇੱਕ ਕਵਿਤਾ ਹੁੰਦੀ ਸੀ ਜੋ ਸਮੇਂ ਦੇ ਨਾਲ ਸੀ ਸਮੇਂ ਦੇ ਉੱਤੇ ਦੱਸਦੀ ਹੁੰਦੀ ਕਿ ਉਹ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਸੀ ਅਤੇ ਮੈਨੂੰ ਉਹ ਬਹੁਤ ਹੀ ਵਧੀਆ ਲੱਗੀ ਕਿਉਂਕਿ ਉਸ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਜੋ ਸਮਾਂ ਆ ਉਹ ਕਿਸੇ ਵਾਸਤੇ ਨਹੀਂ ਰੁਕਦਾ ਅਤੇ ਉਹ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਇਨਸਾਨ ਰੁਕ ਸਕਦਾ ਹੈ ਪਰ ਉਸਦੇ ਵਾਸਤੇ ਸਮਾਂ ਕਦੇ ਨਹੀਂ ਰੁਕ ਸਕਦਾ ਜਦੋਂ ਸਮਾਂ ਨਿਕਲ ਜਾਂਦਾ ਹੈ ਤਾਂ ਇਨਸਾਨ ਕੁਛ ਵੀ ਨਹੀਂ ਕਰ ਸਕਦਾ ਇਸ ਵਾਸਤੇ ਸਾਨੂੰ ਹ ਹਰ ਇੱਕ ਕੰਮ ਹਰ ਇੱਕ ਚੀਜ਼ ਸਮੇਂ 'ਤੇ ਹੀ ਕਰਨੀ ਚਾਹੀਦੀ ਹੈ ਅਤੇ ਸਮੇਂ ਨੂੰ ਹਮੇਸ਼ਾ ਹੀ ਆਪਣੇ ਜੀਵਨ ਵਿੱਚ ਧਿਆਨ ਦੇ ਨਾਲ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਇੱਕ ਵਾਰ ਸਮਾਂ ਲੰਘ ਜਾਂਦਾ ਹੈ ਉਹ ਕਦੇ ਮੁੜ ਕੇ ਨਹੀਂ ਆਉਂਦਾ ਇਹ ਭਾਈ ਵੀਰ ਸਿੰਘ ਜੀ ਨੇ ਹੀ ਕਿਹਾ ਗਿਆ ਕਿਹਾ ਸੀ ਭਾਈ ਵੀਰ ਸਿੰਘ ਜੀ ਨੇ ਕਵਿਤਾਵਾਂ ਨੂੰ ਅਤੇ ਕਵਿਤਾ ਨੂੰ ਅਤੇ ਕਵੀ ਨੂੰ ਇੱਕ ਅਲੱਗ ਪੱਧਰ 'ਤੇ ਹੀ ਲੈ ਕੇ ਗਏ ਸੀ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀ ਰਚਨਾਤਮਕ ਸੋਚ ਅਤੇ ਉਹਨਾਂ ਦੀ ਕਵਿਤਾਵਾਂ ਦੂਰ ਦੂਰ ਤੱਕ ਪ੍ਰਸਿੱਧ ਹਨ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਉਹ ਅਪ ਆਪਾਂ ਨੂੰ ਉਹਨਾਂ ਦੀ ਕਵਿਤਾਵਾਂ ਬਾਰੇ ਸੁਣਨ ਨੂੰ ਮਿਲਦਾ ਹੈ ਅਤੇ ਉ ਉਸ ਵਿੱਚ ਉਹਨਾਂ ਦੀ ਸੋਚ ਬਾਰੇ ਵੀ ਪਤਾ ਲੱਗਦਾ ਹੈ ਅਤੇ ਇਸ ਤਰ੍ਹਾਂ ਹੀ ਉਹ ਮੇਰੇ ਸਭ ਤੋਂ ਜੋ ਮੈਨੂੰ ਸਭ ਤੋਂ ਵਧੀਆ ਜੋ ਕਵੀ ਲੱਗਦੇ ਹਨ ਉਹ ਭਾਈ ਵੀਰ ਸਿੰਘ ਜੀ ਹਨ ਅਤੇ ਉਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਹੈ ਜਿਸਦਾ ਜੇ ਆਪਾਂ ਵਰਣਨ ਕਰਨ ਲੱਗੀਏ ਤਾਂ ਉਹ ਆਪਾਂ ਕਰ ਹੀ ਨਹੀਂ ਸਕਦੇ ਧੰਨਵਾਦ ਜੀ